ਪੰਜਾਬ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਆਰਟ ਗੈਲਰੀਆਂ ਅਤੇ ਅਜਾਇਬ ਘਰ ਬਣੇ ਹੋਏ ਹਨ ਪੰਜਾਬ ਵਿੱਚ ਆਨੰਦਪੁਰ ਸਾਹਿਬ ਵਿਖੇ ਅਜੂਬਾ ਬਣਿਆ ਹੋਇਆ ਹੈ ਜਿਸ ਵਿੱਚ ਪੰਜਾਬ ਦੇ ਇਤਿਹਾਸ ਨਾਲ਼ ਸੰਬੰਧਿਤ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਰਚਿਤ ਕੀਤੀਆਂ ਗਈਆਂ ਹਨ ਸਾਨੂੰ ਆਪਣੇ ਬੱਚਿਆਂ ਨੂੰ ਜਾ ਲੈਣ ਨਾਲ਼ ਲੈ ਕੇ ਜਾਣਾ ਚਾਹੀਦਾ ਹੈ ਅਤੇ ਉਸ ਅਜੂਬੇ ਨੂੰ ਦਿਖਾਉਣਾ ਚਾਹੀਦਾ ਕਿ ਕਿਵੇਂ ਵੀ ਸਿੱਖ ਇਤਿਹਾਸ ਕਿਵੇਂ ਦਾ ਸੀ ਕਿਵੇਂ ਕਿਵੇਂ ਆਨੰਦਪੁਰ ਸਾਹਿਬ ਦਾ ਕਿਲ੍ਹੇ ਦੇ ਵਿੱਚ ਜਲਿਆਂਵਾਲੇ ਬਾਗ਼ ਦਾ ਕਾਂਡ ਦਾ ਸਾਰਾ ਮਤਲਬ ਉੱਥੇ ਦਿਖਾਇਆ ਗਿਆ ਹੈ ਦ੍ਰਿਸ਼ ਦੇ ਵਿੱਚ ਉਹ ਸਾਰਾ ਉਸ ਦੇ ਨਾਲ਼ ਜਿਹੜਾ ਅਜੂਬ ਮਤਲਬ ਜਿਹੜੀਆਂ ਉੱਥੇ ਇਤਿਹਾਸਕ ਘਟਨਾਵਾਂ ਰਚਿਤ ਕੇ ਉਸ ਨਾਲ਼ ਸਾਡੇ ਬੱਚਿਆਂ ਨੂੰ ਪਤਾ ਚੱਲਦਾ ਹੈ ਕਿ ਸਾਡਾ ਇਤਿਹਾਸ ਪਹਿਲਾਂ ਕਿਹੋ ਜਿਹਾ ਸੀ